ਸਾਡੇ ਇਲਾਕੇ ਦੇ ਪਾਸ ਵਿੱਚ ਬਹੁਤ ਸਾਰੇ ਮਸ਼ਹੂਰ ਕੋਲਜ ਹਨ ਸਾਡੇ ਪਿੰਡ ਦੇ ਵਿੱਚ ਵੀ ਇੱਕ ਕੋਲਜ ਹੈ ਜਿਸ ਦਾ ਨਾਂ ਮਾਤਾ ਗੁਜਰੀ ਕੋਲਜ ਹੈ ਉਹਦੇ ਵਿੱਚ ਪਿੰਡ ਦੀ ਕੁੜੀਆਂ ਨੂੰ ਮੁਫ਼ਤ ਸਿੱਖਿਆ ਦਿੱਤੀ ਜਾਂਦੀ ਹੈ ਸਾਡੇ ਇਲਾਕੇ ਦੇ ਵਿੱਚ ਪੰਜਾਬ ਯੂਨੀਵਰਸਿਟੀ ਵੀ ਹੈ ਅਸੀਂ ਮੈਂ ਉਸ ਤੋਂ ਬੀ ਸੀ ਏ ਕੀਤੀ ਹੈ ਮੇਰੇ ਘਰ ਦੇ ਵਿੱਚ ਮੇਰਾ ਭਰਾ ਅਤੇ ਮੇਰੀ ਭੈਣ ਉਹ ਵੀ ਪੀ ਯੂ ਦੇ ਪੰਜਾਬ ਯੂਨੀਵਰਸਿਟੀ ਦੇ ਅੰਡਰ ਹੀ ਪੜ੍ਹੇ ਹਨ ਉਹ ਮੇਰੇ ਭਰਾ ਨੇ ਬੀ ਏ ਕੀਤੀ ਹੈ ਬੈਚਲਰ ਆਫ਼ ਆਰਟਸ ਅਤੇ ਮੇਰੀ ਭੈਣ ਨੇ ਪਹਿਲਾਂ ਐਮ ਬੀ ਕੌਮ ਕੀਤੀ ਹੈ ਅਤੇ ਫਿਰ ਐੱਮ ਬੀ ਏ ਕੀਤੀ ਹੈ ਉੱਥੋਂ ਦਾ ਪੜ੍ਹਾਉਣ ਦਾ ਟੀਚਿੰਗ ਬਹੁ ਟੀਚਿੰਗ ਦਾ ਤਰੀਕਾ ਬਹੁਤ ਹੀ ਵਧੀਆ ਹੈ